ਸਾਡੇ ਹਸਪਤਾਲਾਂ ਵਿੱਚ ਐਕਸ ਰੇਅ ਸੀ ਟੀ ਸਕੈਨ ਐਮਰ ਐ ਐੱਮ ਆਈ ਆਰ ਆਈ ਸਕੈਨ ਲਈ ਨਹੀਂ ਹੈ ਸਾਨੂੰ ਇਸ ਲਈ ਬਾਹਰ ਜਾਣਾ ਪੈਂਦਾ ਹੈ ਅਤੇ ਕੋਈ ਵੀ ਟੈਸਟ ਖੂਨ ਦੀ ਜਾਂਚ ਵੀ ਵਿਸ਼ਾਲ ਦੀ ਜਾਂਚ ਸੀ ਟੀ ਸਕੈਨ ਬਲੱਡ ਪ੍ਰੈਸਰ ਦੀ ਜਾਂਚ ਆਦਿ ਕਰਨ ਲਈ ਹੋਰ ਸਾਨੂੰ ਬਾਹਰ ਜਾਣਾ ਪੈਂਦਾ ਹੈ ਕੋਈ ਐਂਬੂਲੈਂਸ ਦੀ ਵੀ ਕੋਈ ਸਹੂਲਤ ਨਹੀਂ ਹੈ ਡਾਕਟਰ ਵੀ